ਹੈਲੋ ਹਾਂਜੀ ਸਰ ਨਮਸਕਾਰ ਜੀ ਹਾਂਜੀ ਸਰ ਸਰ ਸਟੇਸ਼ਨ ਮਾਸਟਰ ਸਰ ਸਾਹਿਬ ਬੋਲ ਰਹੇ ਹੋ ਜੀ ਠੀਕ ਹੈ ਸਰ ਮੈਂ ਵਰਿੰਦਰ ਕੁਮਾਰ ਅਮ ਸਰ ਬੋਲ ਰਿਹਾ ਮੈਂ ਇੱਧਰ ਟੂਰਿਸਟ ਆ ਮੈਂ ਘੁੰਮਣ ਆਇਆ ਇੱਥੇ ਪਠਾਨਕੋਟ 'ਚ ਹਾਂਜੀ ਅਤੇ ਸਰ ਮੈਂ ਟਰੇਨਾਂ ਬਾਰੇ ਪਤਾ ਕਰਨਾ ਸੀ ਬਈ ਇੱਥੋਂ ਜਿਹੜੀ ਹੈ ਟ੍ਰੇਨ ਮਤਲਬ ਬਈ ਕਿੱਧਰ ਕਿੱਧਰ ਨੂੰ ਜਾਂਦੀ ਆ ਔਰ ਕਿਹੜੀ ਕਿਹੜੀ ਟ੍ਰੇਨ ਹੈ ਔਰ ਕੀ ਕੀ ਉਹਦਾ ਟਾਈਮ ਹੈਗਾ ਇਹਦੇ ਬਾਰੇ ਪੁੱਛਣਾ ਸੀ ਮੈਂ ਠੀਕ ਠੀਕ ਏ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਠੀਕ ਹੈ ਸਰ ਓਕ ਠੀਕ ਹੈ ਠੀਕ ਹੈ ਤੇ ਠੀਕ ਹੈ ਸਰ ਅਤੇ ਸਰ ਟਾਈਮ ਕੀ ਆ ਉਹਦਾ ਅੱਛਾ ਅੱਛਾ ਅਤੇ ਮਤਲਬ ਬਈ ਬੁਕਿੰਗ ਜਿਹੜੀ ਆ ਉਹਦੀ ਸਾਨੂੰ ਸੀਟ ਮਿਲ ਜਾਏਗੀ ਜਾਂ ਵੇਟਿੰਗ 'ਚ ਪਏਗੀ ਠੀਕ ਹੈ ਸਰ ਫਿਰ ਠੀਕ ਹੈ ਮੈਂ ਔਨਲਾਈਨ ਬੁਕਿੰਗ ਕਰ ਦਿੰਦਾ ਠੀਕ ਹੈ ਠੀਕ ਹੈ ਸਰ ਓਕੇ ਥੈਂਕ ਯੂ ਸਰ ਮਿਹਰਬਾਨੀ